ਮੈਂ ਮਮਤਾ ਦੇਵੀ ਪਿੰਡ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਹਾਂਜੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਬਿਲਕੁਲ ਪਿੰਡ 'ਚ ਖੁੱਲ੍ਹੇ 'ਚ ਪਖਾਨਾ ਜਾਣਾ ਕਈ ਪੱਧਰਾਂ 'ਤੇ ਨੁਕਸਾਨ ਕਰ ਸਕਦਾ ਹੈ ਇਹ ਪੀਣੇ ਦੇ ਪ੍ਰਾਣੀਆਂ ਦੇ ਖਤਰੇ ਦੀ ਵਜੋਂ ਨਹੀਂ ਹੈ ਹਿੱਸਾ ਲੈਂਦਾ ਹੈ ਪਰ ਇਸ ਨਾਲ ਕਿਸਾਨਾਂ ਦੀ ਖੇਤੀਬਾੜੀ ਉੱਤੇ ਨੈਗਟਿਵ ਪ੍ਰਭਾਵ ਪੈਂਦਾ ਹੈ ਖੁੱਲ੍ਹੇ 'ਚ ਪਖਾਨਾ ਵਾਲੇ ਪਿੰਡ ਵਿੱਚ ਹਵਾ ਅਤੇ ਪ੍ਰਦੂਸ਼ਣ ਦਾ ਸਤਿਕਾਰ ਹੋਣਾ ਸਮੱਸਿਆ ਬਣ ਜਾਂਦਾ ਹੈ ਅਤੇ ਸਾਡੀ ਅਸਮਾਨੀ ਦੂਸਰੇ ਪ੍ਰਾਣੀਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਇਸ ਨਾਲ ਪਿੰਡ ਦੇ ਪਾਣੀ ਅਤੇ ਮਿੱਟੀ ਉੱਤੇ ਵੀ ਅਸਰ ਪੈਂਦਾ ਹੈ ਜਿਸ ਕਾਰਨ ਮਿੱਟੀ ਦੀ ਕਿਸਾਨੀ ਉੱਤੇ ਹਾਨੀਕਾਰਕ ਅਸਰ ਪੈਂਦਾ ਹੈ ਇਸ ਤਰ੍ਹਾਂ ਬਾਹਰ ਵਿਰਸਾ ਅਤੇ ਕਨ ਖੋਜਲੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਜਿਵੇਂ ਕਿ ਵਾਪਸੀ ਦਰਿਆਈ ਪ੍ਰਣਾਲੀ ਦੀ ਸੁਸਤੀ ਅਤੇ ਸਮੁੰਦਰ ਦੇ ਜੀਵ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਇਸ ਲਈ ਖੁੱਲ੍ਹੇ 'ਚ ਪਖਾਨੇ ਦਾ ਹੋਰ ਪ੍ਰਭਾਵ ਵੀ ਪਿੰਡ ਦੇ ਸਮੂਹ ਵਿਕਾਸ ਅਤੇ ਪਰਿਵਾਰਾਂ 'ਤੇ ਅਸਰ ਹੋ ਸਕਦਾ ਹੈ ਇਸ ਨਾਲ ਕਈ ਬਿਮਾਰੀਆਂ ਵੀ ਲੱਗਦੀਆਂ ਹਨ ਖੁੱਲ੍ਹੇ 'ਚ ਪਖਾਨਾ ਜਾਣ ਨਾਲ ਸਾਨੂੰ ਕਈ ਸਾਰੇ ਰੋਗਾਂ ਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਖੁੱਲ੍ਹੇ 'ਚ ਪਖਾਨਾ ਨਹੀਂ ਜਾਣਾ ਚਾਹੀਦਾ ਹੈ